ਹਾਂਜੀ ਸਾਡੇ ਇਲਾਕੇ ਵਿੱਚ ਬਹੁਤ ਮਸ਼ਹੂਰ ਕੋਲਜ ਹਨ ਜੋ ਕਿ ਚੰਡੀਗੜ੍ਹ ਵਿੱਚ ਪੰਜਾਬੀ ਯੂਨੀ ਪੰਜਾਬ ਯੂਨੀਵਰਸਿਟੀ ਹੈ ਉਹ ਬਹੁਤ ਮਸ਼ਹੂਰ ਹੈ ਉਹਦੇ ਨਾਲੇ ਪੰਜ ਸੱਤ ਕੋਲਜ ਹੈ ਬਹੁਤ ਸਿਰ ਕੱਢ ਕੋਲਜ ਹੈ ਜੇ ਉਹ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਬਾਕੀ ਆਪਣੇ ਸਾਡੇ ਮੋਹਾਲੀ ਵਿੱਚ ਛੇ ਫ਼ੇਸ ਵਿੱਚ ਵਧੀਆ ਕੋਲਜ ਆ ਕੁੜੀਆਂ ਮੁੰਡਿਆਂ ਦਾ ਅਤੇ ਇੰਜੀਨੀਅਰੀ ਕੋਲਜ ਇੱਕ ਖੁੰਨੀ ਮਾਜਰੇ ਹੈਗਾ ਏ ਜੀ ਅਤੇ ਬਾਕੀ ਕੋਲਜ ਪ੍ਰਾਈਵੇਟ ਅਦਾਰੇ ਹੈਗੇ ਕੋਲਜ ਜਿਹੜੇ ਚਿੱਤਕਾਰਾ ਦੁਆਬਾ ਰਿਆਤ ਬਾਰਾ ਸੀ ਜੀ ਸੀ ਜਿਹੜੇ ਸਾਰੇ ਪੱਚੀ ਤੀਹ ਕਿੱਲੋਮੀਟਰ ਦੀ ਰੇਂਜ ਵਿੱਚ ਨੇ ਬਾਕੀ ਜਿਸ ਨੇ ਪੜ੍ਹਾਈ ਜਿੱਥੇ ਕਰਨੀ ਹੈ ਉਹ ਆਪਣਾ ਕਰਦਾ ਸਾਡੇ ਪਿੰਡੋਂ ਵਧੇਰੇ ਬੱਚੇ ਜਾਂਦੇ ਆ ਕੋਲਜਾਂ ਵਿੱਚ ਪੜ੍ਹਨ ਉਹ ਕੋਈ ਐੱਮ ਏ ਕਰ ਰਿਹਾ ਏ ਕੋਈ ਬੀ ਸੀ ਏ ਕਰ ਰਿਹਾ ਏ ਕੋਈ ਐੱਮ ਐੱਸ ਸੀ ਕਰ ਰਿਹਾ ਹੈ